ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਥੋਤੋਂ ਇਕ ਮੋਬਾਇਲ ਲਿਆ ਤਾ ਜੀ ਮੈਂ ਹਾਂਜੀ ਉਹਦਾ ਬਿਲਕੁਲ ਗਲਾਸ ਵੀ ਬਿਲਕੁਲ ਖਰਾਬ ਹੋਇਆ ਤਾ ਚੀਗਾ ਪਈਆਂ ਵਾ ਤੀਆ ਉੱਪਰ ਹਾਂਜੀ ਕੈਮਰਾ ਵੀ ਠੀਕ ਨਹੀਂ ਹੈਗਾ ਜੀ ਉਹਦਾ ਫੋਟੋ ਵੀ ਸਾਫ ਨਹੀਂ ਆਉਂਦੀ ਜੀ ਨਹੀਂ ਨਹੀਂ ਕੈਮਰਾ ਠੀਕ ਨਹੀਂ ਜੀ ਬਿਲਕੁਲ ਨਹੀਂ ਹੈਗਾ ਜੀ ਹਾਂਜੀ ਆਵਾਜ਼ ਵੀ ਸਾਫ ਨਹੀਂ ਜੀ ਆਉਂਦੀ ਉਹਦੇ ਵਿੱਚ ਟੁੱਟਿਆ ਵਾ ਜੀ ਜਮਾਂ ਹੀ ਬੇਕਾਰ ਫੋਨ ਦੇ ਤਾ ਤੁਸੀਂ ਮੈਨੂੰ ਹਾਂਜੀ ਸਕਰੈਚ ਇੰਨੇ ਪਏ ਪਏ ਤੇ ਜਿਸ ਤਰ੍ਹਾਂ ਪਤਾ ਨਹੀਂ ਦਸ ਸਾਲ ਪੁਰਾਣਾ ਹੁੰਦਾ ਹੈ ਹਾਂਜੀ ਹਾਂਜੀ ਮੈਨੂੰ ਬਦਲ ਕੇ ਦਿਉ ਜੀ ਮੋਬਾਇਲ